ਸਿਹਤ ਸੰਭਾਲ ਆਵਾਜਾਈ ਸਿੱਖਿਆ ਅਤੇ ਹੋਰ ਬੁਨਿਆਦੀ ਲੋੜਾਂ ਦੇ ਦ੍ਰਿਸ਼ਟੀਕੋਣ ਲਈ ਅਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਮਤਲਬ ਸ਼ਹਿਰਾਂ ਵਿੱਚ ਬਿਹਤਰ ਬਣਾਉਣ ਲਈ ਅਸੀਂ ਬਹੁਤ ਸਾਰੇ ਕੰਮ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਸਿਹਤ ਸੰਭਾਲ ਵਿੱਚ ਕਰ ਸਕਦੇ ਹਾਂ ਵੀ ਪਿੰਡਾਂ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਮਤਲਬ ਸਿਹਤ ਸੰਭਾਲ ਸੁਵਿਧਾਵਾਂ ਨੂੰ ਉਪਲੱਬਧ ਕਰਵਾ ਸਕਦੇ ਹਾਂ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਆਪਾਂ ਮੁਫਤ ਜਾਂ ਘੱਟ ਕੀਮਤ 'ਤੇ ਸਿਹਤ ਸ ਸਿਹਤ ਸਬੰਧੀ ਦਵਾਈਆਂ ਹੋ ਗਈਆਂ ਫ੍ਰੀ 'ਚ ਦੇ ਸਕਦੇ ਹਾਂ ਜਾਂ ਘੱਟ ਕੀਮਤਾਂ 'ਤੇ ਦੇ ਸਕਦੇ ਹਾਂ ਜਿਹੜੇ ਡੋਕਟਰ ਨਰਸਾਂ ਹੁੰਦੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖਿਆ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ ਇਹ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਅਤੇ ਆਵਾਜਾਈ ਲਈ ਵੀ ਅਸੀਂ ਬਹੁਤ ਕੁਛ ਕਰ ਸਕਦੇ ਹਾਂ ਜਿਵੇਂ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਧੀਆ ਸੜਕਾਂ ਬਣਾ ਸਕਦੇ ਹਾਂ ਟਰਾਂਸਪੋਰਟ ਸੇਵਾਵਾਂ ਵਧੀਆ ਕਰ ਸਕਦੇ ਹਾਂ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਅੱਡਾ ਬਣਾ ਸਕਦੇ ਹਾਂ ਅਤੇ ਜੇ ਲੋਕਾਂ ਨੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੈਦਲ ਚੱਲਣਾ ਪ੍ਰੈਫਰ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਸਿਹਤ ਵਧੀਆ ਰਹੇ ਅਤੇ ਸਿੱਖਿਆ ਦੇ ਵਿੱਚ ਵੀ ਅਸੀਂ ਬਹੁਤ ਸਾਰੀਆਂ ਚੇਂਜਿਸ ਕਰ ਸਕਦੇ ਹਾਂ ਜਿਵੇਂ ਕਿ ਬਿਹਤਰ ਸਕੂਲ ਬਣਾ ਸਕਦੇ ਹਾਂ ਕੋਲਜ ਬਣਾ ਸਕਦੇ ਹਾਂ ਜਿਹਦੇ ਵਿੱਚ ਕੀ ਗਰੀਬ ਵਿਦਿਆਰਥੀਆਂ ਦੇ ਲਈ ਆਪਾਂ ਸਕੋਲਰਸ਼ਿਪ ਦੀ ਉਪਲੱਬਧਤਾ ਕਰ ਸਕਦੇ ਹਾਂ ਅਤੇ ਪਿੰਡਾਂ ਵਿੱਚ ਆਧੁਨਿਕ ਸਿੱਖਿਆ ਦੇਣ ਲਈ ਟੈਕਨੋਲਜੀ ਦਾ ਵੀ ਪ੍ਰਬੰਧ ਕਰ ਸਕਦੇ ਹਾਂ ਅਤੇ ਪੀਣ ਦਾ ਪਾਣੀ ਜਿਹੜਾ ਕਿ ਸਾਫ਼ ਉਪਲੱਬਧ ਕਰਵਾਉਣਾ ਚਾਹੀਦਾ ਬਿਜਲੀ ਦਾ